ਹੈਲੋ ਹਾਂਜੀ ਮੈਮ ਮੈਂ ਏ ਡੀ ਸੀ ਕੰਪਨੀ ਤੋਂ ਗੱਲ ਕਰ ਰਿਹਾ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਅਤੇ ਫਿਰ ਮੈਮ ਮੈਨੂੰ ਆਪਣੀ ਜਰਾ ਡਿਟੇਲਜ਼ ਪ੍ਰੋਵਾਈਡ ਕਰ ਦੋਗੇ ਤੁਹਾਡੀ ਤੁਹਾਨੂੰ ਆਈਡੀਆ ਹੋਵੇਗਾ ਤੁਹਾਡਾ ਕਦ ਤੁਹਾਡਾ ਇੰਸ਼ੋਰੈਂਸ ਹੁਣ ਮਤਲਬ ਹੈਗਾ ਅ ਖ਼ਤਮ ਹੋਣ ਵਾਲਾ ਹੈਗਾ ਅੱਛਾ ਜੀ ਚਲੋ ਮੈਨੂੰ ਆਪਣੇ ਜਰਾ ਪੋਲਿਸੀ ਨੰਬਰ ਤੁਸੀਂ ਅ ਲਿਖਵਾਉਣਾ ਜਰਾ ਮੈਂ ਚੈੱਕ ਡਿਟੇਲਜ਼ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਚਲੋ ਹਾਂਜੀ ਹਾਂਜੀ ਮੈਂ ਜਦੋਂ ਹਾਂਜੀ ਹਾਂਜੀ ਠੀਕ ਹੈ ਮੈਂ ਦੇਖ ਪਾ ਰਿਹਾ ਹੈਗਾ ਸਾਰੀ ਡਿਟੇਲਜ਼ ਅਤੇ ਹਾਂਜੀ ਮੈਨੂੰ ਆਪਣੇ ਆਧਾਰ ਕਾਰਡ ਦੇ ਆਖਰੀ ਤਿੰਨ ਡੀਜਿਟ ਬੋਲਣਾ ਜਰਾ ਅਤੇ ਬਾਈਕ 'ਤੇ ਉਹ ਤੁਹਾਡੀ ਗੱਡੀ ਦੇ ਜਿਹੜੇ ਆਖਰੀ ਤਿੰਨ ਡੀਜਿਟਜ਼ ਉਹ ਵੀ ਦੱਸ ਦਿਓ ਇੱਕ ਵਾਰੀ ਕੰਫਰਮ ਕਰਨ ਵਾਸਤੇ ਓਕੇ ਓਕੇ ਹਾਂਜੀ ਸਾਡੀ ਡਿਟੇਲਜ਼ ਮੈਚ ਹੋ ਚੁੱਕੀਆਂ ਹੈਗੀਆਂ ਅੱਛਾ ਜੀ ਅਤੇ ਕਿੰਨਾ ਕੁ ਤੁਹਾਡਾ ਪ੍ਰੀਮੀਅਮ ਬਣਿਆ ਸੀ ਮੈਡਮ ਕਿੰਨਾ ਕੁ ਤੁਹਾਡਾ ਖਰਚਾ ਆਇਆ ਸੀ ਅੱਛਾ ਅੱਛਾ ਮੈਂ ਇੱਕ ਮਿੰਟ ਜਰਾ ਹੋਲਡ ਕਰਨਾ ਮੈਂ ਦੇਖਦਾ ਤੁਹਾਡਾ ਥੋੜ੍ਹਾ ਜਿਹਾ ਪ੍ਰੀਮੀਅਮ ਵਧੇਗਾ ਕਿਉਂਕਿ ਤੁਸੀਂ ਇੰਸ਼ੋਰੈਂਸ ਕਲੇਮ ਕਰ ਲਈ ਸੀ ਅਤੇ ਉਹਦੇ ਕਰਕੇ ਫਿਰ ਤੁਹਾਡਾ ਥੋੜ੍ਹਾ ਜਿਹਾ ਨਾ ਪ੍ਰਾਈਜ ਵੱਧ ਜਾਏਗਾ ਅਤੇ ਮੈਂ ਹੁਣ ਚੈੱਕ ਕਰਕੇ ਦੱਸਦਾ ਤੁਹਾਨੂੰ ਹੁਣੇ ਇੱਕ ਮਿੰਟ ਜਰਾ ਹੋਲਡ ਕਰਨਾ ਜਿੱਦਾਂ ਕਿ ਮੈਮ ਮੈਂ ਦੇਖ ਪਾ ਰਿਹਾ ਪਿਛਲੀ ਵਾਰੀ ਤੁਸੀਂ ਅਠਾਰਾਂ ਹਜ਼ਾਰ ਦੀ ਇੰਸ਼ੋਰੈਂਸ ਹੋਈ ਸੀ ਤੁਹਾਡੀ ਗੱਡੀ ਦੀ ਅਤੇ ਤੁਹਾਡਾ ਇੰਸ਼ੋਰੈਂਸ ਕਲੇਮ ਕਰਨ ਕਰਕੇ ਇਸ ਵਾਰੀ ਤੁਹਾਡੀ ਜਿਹੜੀ ਇਨਸ਼ੋਰੈਂਸ ਹੈਗੀ ਹੈ ਉਹ ਚੌਵੀ ਹਜ਼ਾਰ ਦੀ ਅ ਬਣਦੀ ਹੈਗੀ ਹੈ ਹਾਂਜੀ ਹਾਂਜੀ ਫਿਰ ਉਹ ਤੁਹਾਡਾ ਪ੍ਰੀਮੀਅਮ ਵੱਧ ਰਿਹਾ ਹੈਗਾ ਜਿਹਦੇ ਕਰਕੇ ਇਹ ਤੁਸੀਂ ਮੈਡਮ ਇਹਦੇ ਵਿੱਚ ਕੋਈ ਅ ਐਡ ਔਨਸ ਵਗੈਰਾ ਵੀ ਲੈਣਾ ਚਾਹੁੰਦੇ ਹੋ ਕਿ ਜਿੱਦਾਂ ਤੁਹਾਡੀ ਚਾਬੀ ਗੁਆਚ ਗਈ ਜਾਂ ਕੁਛ ਫਲੈਟ ਹੈ ਚਾਬੀ ਵਾਲੀ ਲੈਣੀ ਹੈ ਜੀ ਤੁਸੀਂ ਐਡ ਆਨ ਸਰਵਿਸ ਅੱਛਾ ਜੀ ਉਹ ਕਰਕੇ ਫਿਰ ਹਜ਼ਾਰ ਰੁਪਇਆ ਹੋਰ ਜੁੜ ਜਾਵੇਗਾ ਅਤੇ ਫਿਰ ਤੁਹਾਡਾ ਪੱਚੀ ਹਜ਼ਾਰ ਰੁਪਇਆ ਹੋ ਜੇਗਾ ਹਾਂਜੀ ਹਾਂਜੀ ਅਤੇ ਰੋਡ ਅਸਿਸਟੈਂਟ ਵੀ ਤੁਸੀਂ ਲੈਣਾ ਚਾਹੁੰਦੇ ਜੇ ਤੁਹਾਨੂੰ ਕੱਲ੍ਹ ਨੂੰ ਤੁਹਾਡੀ ਗੱਡੀ ਗੁੱਡੀ ਖ਼ਰਾਬ ਹੋ ਜਾਵੇ ਅਤੇ ਫਿਰ ਉਹ ਟੋਇੰਗ ਵੈਨ ਆ ਟੋ ਕਰਕੇ ਲੈ ਕੇ ਜਾ ਸਕਦੀ ਉਹ ਵੀ ਇੱਕ ਆਪਸ਼ਨ ਹੁੰਦੀ ਹੈਗੀ ਉਹਦੇ ਅਲੱਗ ਤੋਂ ਪੰਦਰਾਂ ਹਜ਼ਾਰ ਰੁਪਏ ਹੈ ਆ ਪੰਦਰਾਂ ਸੌ ਰੁਪਏ ਹੈਗੇ ਹੈ ਉਹ ਵੀ ਐਡ ਹੋ ਚੁੱਕੇ ਹਾਂਜੀ ਹਾਂਜੀ ਹਾਂਜੀ ਬਸ ਤੁਹਾਡਾ ਹੁਣ ਸਤਾਈ ਕੁ ਹਜ਼ਾਰ ਰੁਪਇਆ ਬਿੱਲ ਬਣ ਓ ਅ ਬਣ ਰਿਹਾ ਵਿਧ ਟੈਕਸ ਓਲ ਅਤੇ ਉਹ ਚੀਜ਼ ਹੈਗੀ ਆ ਮੈਂ ਤੁਹਾਨੂੰ ਨਾ ਇੱਕ ਲਿੰਕ ਭੇਜ ਰਿਹਾ ਤੁਹਾਡੇ ਇਸੀ ਵਟਸਅਪ ਨੰਬਰ ਦੇ ਉੱਤੇ ਤੁਸੀਂ ਉਹਨੂੰ ਕਲਿੱਕ ਕਰਕੇ ਉਹਦੇ ਵਿੱਚ ਆਪਣੀ ਪੇਮੈਂਟ ਲਿੰਕ ਤੁਹਾਨੂੰ ਆਏਗਾ ਅਤੇ ਉਹ ਤੁਸੀਂ ਪੇ ਕਰਨਾ ਅਤੇ ਤੁਹਾਨੂੰ ਜਿਹੜੀ ਤੁਹਾਡੀ ਇੰਸ਼ੋਰੈਂਸ ਹੈਗੀ ਆ ਉਹ ਤੁਹਾਡੀ ਮੇਲ ਦੇ ਉੱਤੇ ਤੁਹਾਨੂੰ ਪ੍ਰੋਵਾਈਡ ਹੋ ਜੇਗੀ ਮਿਲ ਜੇਗੀ ਤੁਹਾਨੂੰ ਹਾਂਜੀ ਹਾਂਜੀ ਠੀਕ ਹੈ ਜੀ ਹੋਰ ਕੋਈ ਸੇਵਾ ਮੈਡਮ ਜੇ ਤੁਸੀਂ ਸਾਡੇ ਤੋਂ ਕੁਛ ਪੁੱਛਣਾ ਚਾਹੁੰਦੇ ਹੋ ਠੀਕ ਆ ਸਾਡੇ ਇੰਸ਼ੋਰੈਂਸ ਦੇ ਵਿਭਾਗ ਵਿੱਚ ਗੱਲ ਕਰਨ ਦੀ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ